ਭੰਗੜਾ ਜਿਹੜਾ ਪੰਜਾਬੀਆਂ ਦਾ ਬਹੁਤ ਮਹੱਤਵਪੂਰਨ ਹੈ ਭੰਗੜੇ ਤੋਂ ਬਗੈਰ ਵਿਆਹ ਅਧੂਰਾ ਰਹਿੰਦਾ ਹੈ ਹਰੇ ਹਰੇਕ ਖੁਸ਼ੀ ਵਾਲੀ ਥਾਂ 'ਤੇ ਭੰਗੜਾ ਪਾਇਆ ਜਾਂਦਾ ਹੈ ਹਰੇ ਹਰੇਕ ਥਾਂ ਯਾਨੀ ਜਦ ਆਪਾਂ ਖੁਸ਼ੀ ਮਨਾਉਂਦੇ ਹਾਂ ਤਾਂ ਭੰਗੜੇ ਦੀ ਜ਼ਰੂਰਤ ਹੀ ਪੈਂਦੀ ਹੈ ਵਿਆਹ ਹੋਵੇ ਸ਼ਾਦੀਆਂ ਹੋਣ ਹਾਂ ਕੋਈ ਖੁਸ਼ੀਆਂ ਕੋਈ ਲੋਹੜੀ ਕੋਈ ਇੱਦਾਂ ਦਾ ਪ੍ਰੋਗਰਾਮ ਹੋਵੇ ਉੱਥੇ ਭੰਗੜਾ ਹੀ ਜ਼ਰੂਰੀ ਹੈ